ਕੁਝ ਸ ਸਮੇਂ ਪਹਿਲਾਂ ਮੇਰੇ ਸਕੂਲ ਵਿੱਚ ਫੈਸਟ ਸੀ ਜਿੱਥੇ ਮੈਂ ਪਾਰਟੀਸਪੇਟ ਕੀਤਾ ਅਤੇ ਮੈਨੂੰ ਬਹੁਤ ਖੁਸ਼ੀ ਮਿਲੀ ਮੈਂ ਇਸ ਪੇਂਟਿੰਗ ਕੌਮਪੀਟੀਸ਼ਨ ਵਿੱਚ ਪਾਰਟੀਸਪੇਟ ਕੀਤਾ ਅਤੇ ਮੈਂ ਆਪਣੀ ਪੇਂਟਿੰਗ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ਼ ਸਜਾਇਆ ਮੈਂ ਇਸ 'ਤੇ ਕਾਫ਼ੀ ਜ਼ਿਆਦਾ ਸਟਾਰਸ ਐਂਡ ਡੈਕੋਰੇਟਿੱਵ ਆਈਟਮਸ ਯੂਜ਼ ਕੀਤੀਆਂ ਜਿਸ ਦੌਰਾਨ ਬਹੁਤ ਸਾਰੇ ਲੋਕ ਇਸ ਪੇਂਟਿੰਗ ਨੂੰ ਵੇਖਣ ਲਈ ਆਕਰਸ਼ਿਤ ਹੋਏ ਅਤੇ ਇੱਕ ਉੱਥੇ ਇੱਕ ਬਲੌਗਰ ਵੀ ਆਇਆ ਹੋਇਆ ਸੀ ਉਹ ਵੀ ਮੇਰੀ ਪੇਂਟਿੰਗ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਸਨੇ ਆਪਣਾ ਪੂਰਾ ਬਲੌਗ ਮੇਰੀ ਪੇਂਟਿੰਗਸ 'ਤੇ ਸ਼ੂਟ ਕੀਤਾ ਜਿਸ ਕਾਰਨ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੇਰੇ ਫ੍ਰੈਡਸ ਵੀ ਬਹੁਤ ਖੁਸ਼ ਹੋਏ ਸਭ ਉਸ ਬਲੌਗਰ ਨੇ ਮੇਰਾ ਨਾਮ ਪਤਾ ਅਤੇ ਬਾਅਦ ਵਿੱਚ ਇੰਨਟਰਵਿਊ ਵੀ ਲਿੱਤੀ ਜਿਸ ਵਿੱਚ ਮੇਰਾ ਪ੍ਰੋਪਰ ਨਾਮ ਪਤਾ ਦੱਸਿਆ ਅਤੇ ਜਿਸ ਕਾਰਨ ਮੈਂ ਬਾਅਦ ਵਿੱਚ ਬਹੁਤ ਫੇਮਸ ਹੋ ਗਿਆ ਅਤੇ ਸਕੂਲ ਵਿੱਚ ਸਾਰੇ ਮੈਨੂੰ ਸਤਿਕਾਰ ਦੇਣ ਲੱਗ ਪਏ ਅਤੇ ਮੇਰੀ ਪੇਂਟਿੰਗਸ ਨੂੰ ਲਾਈਕ ਕਰਨ ਲੱਗ ਪਏ